ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਰਾਜ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਉਦੋਂ ਤਾਂ ਭਾਰਤ ਵਿਚ ਬੜੇ ਹੀ ਧਾਰਮਿਕ ਅਸਥਾਨ ਹਨ ਜਿਹਨਾਂ 'ਤੇ ਲੋਕ ਅਕਸਰ ਜ਼ਿਆਦਾ ਜਾਂਦੇ ਹਨ ਪਰ ਮੈਂ ਆਪਣੇ ਅੰਮ੍ਰਿਤਸਰ ਦੀ ਗੱਲ ਕਰਾਂਗਾ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਸਭ ਤੋਂ ਪਹਿਲੇ ਮੈਂ ਗੱਲ ਕਰਦਾ ਆਪਣੇ ਹਰਿਮੰਦਰ ਸਾਹਿਬ ਦੀ ਜਿਹੜਾ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਉਸਦੇ ਚਾਰ ਦਰਵਾਜ਼ੇ ਹਨ ਚਾਰ ਦਰਵਾਜ਼ਿਆਂ ਦਾ ਭਾਵ ਹੈ ਇਹ ਕਿ ਉਸਦੇ ਅੰਦਰ ਸਾਰੇ ਧਰਮਾਂ ਦੇ ਲੋਕ ਆ ਸਕਦੇ ਹਨ ਹੁਣ ਭਾਵੇਂ ਹਿੰਦੂ ਹੋਣ ਭਾਵੇਂ ਇਸਾਈ ਹੋਣ ਭਾਵੇਂ ਸਿੱਖ ਹੋਵੇ ਭਾਵੇਂ ਮੁਸਲਮਾਨ ਹੋਵੇ ਇੱਥੇ ਸਭ ਨੂੰ ਇੱਕ ਸਾਰ ਮੰਨਿਆ ਜਾਂਦਾ ਕੋਈ ਵੀ ਅਮੀਰ ਗਰੀਬ ਨਹੀਂ ਹੁੰਦਾ ਸਭ ਇੱਕ ਅਨੁਸਾਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਤਾਂ ਕਿ ਸਾਰ ਬਹਿ ਇੱਕ ਸਾਰ ਬਹਿ ਕੇ ਲੰਗਰ ਛਕਦੇ ਆ ਇੱਕੋ ਪੰਗਤ ਵਿਚ ਬਹਿ ਕੇ ਠੀਕ ਹੈ ਆਹ ਜਿੰਦਾ ਹੁਣ ਗੱਲ ਕੀਤੀ ਜਾਵੇ ਤਾਂ ਧਾਰਮਿਕ ਪ੍ਰੰਪਰਾਵਾਂ ਜਾ ਤਿਉਹਾਰ ਦੀ ਜਿੱਦਾਂ ਸਾਡੇ ਗੁਰੂਆਂ ਦੀ ਗੁਰੂ ਜੀ ਦਾ ਜਨਮ ਆਉਂਦਾ ਹੈ ਜਨਮ ਆਉਂਦਾ ਉਹ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਸ਼ਾਮ ਨੂੰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਅਤੇ ਸਵੇਰੇ ਅਤੁੱਟ ਲੰਗਰ ਚਲਦੇ ਹਨ ਸਾਰੀ ਸੰਗਤ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਹਾਂ ਜਿਹਨਾਂ ਦੀ ਸਵੇਰ ਦੇ ਟਾਈਮ ਤੋਂ ਲੈ ਕੇ ਨੌ ਤੋਂ ਲੈ ਕੇ ਬਾਰ੍ਹਾਂ ਵਜੇ ਤੱਕ ਜੋ ਵੀ ਲੱਗਦਾ ਪਰ ਪੁਰਾਣੇ ਬਾਬਾ ਜੀ ਦੇ ਗਹਿਣੇ ਸਾਂਭੇ ਹੈਗੇ ਨੇ ਅਤੇ ਉਹ ਸਾ ਉਹ ਸਾਨੂੰ ਦਿਖਾਏ ਜਾਂਦੇ ਹਨ ਨੂੰ ਸੋਨੇ ਦੇ ਦਰਵਾਜ਼ੇ ਲਗਾਏ ਜਾਂਦੇ ਹਨ ਉਸਨੂੰ ਸਾਂਭ ਕੇ ਰੱਖਿਆ ਜਾਂਦਾ ਹੈ ਫਿਰ ਅਗਲੇ ਤਿਉਹਾਰ 'ਤੇ ਲਗਾਇਆ ਜਾਂਦਾ ਹੈ ਕਿ ਜਿੱਦਾਂ ਕਹਿੰਦੇ ਕਿ ਅੰਮ੍ਰਿਤਸਰ ਅੰਮ੍ਰਿਤਸਰ ਦੀ ਦਿਵਾਲੀ ਇਸ ਤਰ੍ਹਾਂ ਸਾਰੇ ਦਰਬਾਰ ਵਿੱਚ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਅਤੇ ਵਿਸਾਖੀ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਜਿੱਦਾਂ ਹੁਣ ਗੱਲ ਕਰੀਏ ਬਸੰਤ ਪੈ ਜਾਵੇ ਜੀ ਬਸੰਤ ਪੈਚਵੀਂ 'ਚ ਛਿਹਾਟਾ ਸਾਹਿਬ ਬੜੀ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਇਸ ਦਿਨ ਇਸਤਰੀਆਂ ਪੀਲੀ ਚੁੰਨੀ ਲੈ ਕੇ ਅਤੇ ਮਰਦ ਪੀਲੀਆਂ ਪੱਗਾਂ ਬੰਨ ਕੇ ਆਉਂਦੇ ਨੇ ਬਾਬਾ ਜੀ ਦੇ ਦਰਸ਼ਨ ਕਰਦੇ ਨੇ ਇਸ ਇਸ ਦਿਨ ਉਸ ਥਾਂ ਉੱਤੇ ਕਈ ਲੋਕ ਪਿੰਨੀਆਂ ਗੁੱਡੇ ਲੈ ਕੇ ਆਉਂਦੇ ਆ ਉਡਾਉਂਦੇ ਆ ਹਨ ਅਤੇ ਬੜੇ ਬੜੀ ਸ਼ਰਧਾ ਨਾਲ ਹੀ ਭਾਰੀ ਮੇਲਾ ਲੱਗਦਾ ਹੈ ਅਤੇ ਲੋਕ ਆ ਕੇ ਮੇਲੇ ਵਿੱਚ ਆਪਣਾ ਮਨੋਰੰਜਨ ਕਰਦੇ ਹਨ ਤਾਂ ਕਿ ਇਸ ਤਰੀਕੇ ਨਾਲ ਸਾਡੇ ਅੰਮ੍ਰਿਤਸਰ ਵਿੱਚ ਬੜੀਆਂ ਹੀ ਧਾਰਮਿਕ ਅਸਥਾਨਾਂ ਹਨ ਜਿਸ ਉੱਤੇ ਬੜੇ ਤਿਉਹਾਰ ਮਨਾਏ ਜਾਂਦੇ ਹਨ ਧੰਨਵਾਦ ਜੀ